ਭੰਗੜੇ ਦੇ ਪ੍ਰਦਰਸ਼ਨ ਲਈ ਆਮ ਤੌਰ 'ਤੇ ਕੁਰਤਾ ਅਤੇ ਚਾਦਰਾ ਕੈਂਠਾ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਸਿਰ ਤੇ ਪਗੜੀ ਦਾ ਇਸਤੇਮਾਲ ਕੀਤਾ ਜਾਂਦਾ ਹੈ ਕਿਉਂਕਿ ਜਿਸ ਤਰਾਂ ਕੋਈ ਵੀ ਕਿਰਿਆ ਹੈ ਕੋਈ ਡਾਂਸ ਹੈ ਯੋਗਾ ਹੈ ਉਸਦੇ ਲਈ ਜੋ ਢੁਕਮਾ ਪਹਿਰਾਵਾ ਉਸਨੂੰ ਹੋਰ ਆਕਰਸ਼ਿਤ ਬਣਾ ਦਿੰਦਾ ਹੈ ਜਿਵੇਂ ਕਿ ਨਾਟਕ ਖੇਡਣ ਵੇਲੇ ਇੱਕ ਪਾਤਰ ਦੇ ਪਹਿਰਾਵੇ ਤੋਂ ਹੀ ਉਸਦੀ ਪਹਿਚਾਨ ਹੋ ਜਾਂਦੀ ਹੈ ਜਿਵੇਂ ਕਿਸੇ ਡਾਕਟਰ ਨੇ ਡਾਕਟਰ ਦਾ ਪਹਿਰਾਵਾ ਪਾਇਆ ਹੈ ਤਾਂ ਅਸੀਂ ਉਸਦੀ ਡਾਕਟਰ ਵਾਲੇ ਕੱਪੜੇ ਤੋਂ ਹੀ ਪਹਿਚਾਣ ਜਿਹੜੀ ਉਹ ਕਰ ਸਕਦੇ ਆ ਸੋ ਇਸ ਤਰ੍ਹਾਂ ਕਿਸੇ ਵੀ ਕਿਰਿਆ ਨੂੰ ਡਾਂਸ ਨੂੰ ਨਾਟਕ ਨੂੰ ਭੰਗੜੇ ਨੂੰ ਹੋਰ ਆਕਰਸ਼ਿਤ ਬਣਾਉਣ ਦੇ ਲਈ ਢੁਕਵੀਂ ਡਰੈਸ ਦਾ ਹੋਣਾ ਬਹੁਤ ਜਰੂਰੀ ਹੈ ਸੋ ਜੋ ਭੰਗੜੇ ਦੀ ਪੋਸ਼ਾਕ ਹੈ ਸਾਡੇ ਅਨੁਸਾਰ ਇਹ ਡਾਸ ਕਰਨ ਵਾਲਿਆਂ ਨੂੰ ਪੂਰੀ ਫੱਬਦੀ ਹੈ ਢੁੱਕਦੀ ਹੈ ਇਸ ਤਰਹਾਂ ਅਸੀਂ ਇਸ ਡਾਂਸ ਨੂੰ ਭੰਗੜੀ ਨੂੰ ਹੋਰ ਆਕਰਸ਼ਿਤ ਬਣਾ ਦਿੰਦਾ ਹੈ ਅਤੇ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਜੋ ਹੈ ਪੂਰਾ ਮਹੱਤਵਪੂਰਨ ਜਿਹੜੀ ਹੈ ਇਹ ਡਰੈਸ ਜੋ ਇਹ ਪਹਿਰਾਵਾ ਹੈ ਉਹ ਪੂਰੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਧੰਨਵਾਦ ਜੀ